ਮੈਂ ਮਸ਼ਹੂਰੀਆਂ ਦੇ ਵਿੱਚ ਬੜਾ ਦੇਖਿਆ ਸੀ ਵੀ ਐਮਾਜ਼ੋਨ ਦਾ ਸਮਾਨ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਵਾ ਪਰ ਜਦੋਂ ਮੈਂ ਔਡਰ ਕੀਤਾ ਤਾਂ ਉਹ ਸਮਾਨ ਬਿਲਕੁਲ ਵੀ ਵਧੀਆ ਨਹੀਂ ਸੀ ਦੋ ਮਹੀਨੇ ਪਹਿਲਾਂ ਮੈਂ ਐਮਾਜ਼ੋਨ ਤੋਂ ਸੈਮਸੌਂਗ ਦਾ ਚਾਰਜ ਔਡਰ ਕੀਤਾ ਸੀਗਾ ਇਹ ਕੁਲ ਡੇਢ ਕੁ ਸੌ ਰੁਪਏ ਦਾ ਚਾਰਜਰ ਸੀਗਾ ਅਤੇ ਮੈਂ ਆਪਣਾ ਔਡਰ ਕਰਨ ਤੋਂ ਬਾਅਦ ਇੱਕ ਹਫ਼ਤਾ ਉਡੀਕਿਆ ਅਤੇ ਬਾਅਦ ਤਾਂ ਵੀ ਮੇਰਾ ਔਡਰ ਨਹੀਂ ਆਇਆ ਫਿਰ ਮੈਂ ਐਮਾਜ਼ੋਨ ਵਾਲਿਆਂ ਨੂੰ ਮੇਲ ਕੀਤੀ ਅਤੇ ਜਦੋਂ ਮੈਂ ਮੇਲ ਕੀਤੀ ਤਾਂ ਦੋ ਦਿਨਾਂ ਬਾਅਦ ਉਹਨਾਂ ਦਾ ਰਿਪਲਾਈ ਆਇਆ ਅਤੇ ਰਿਪਲਾਈ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਜਿੰਨੀ ਜਲਦੀ ਹੋ ਸਕਦਾ ਉਨੀ ਜਲਦੀ ਮੇਰਾ ਔਡਰ ਭੇਜ ਦੇਣਗੇ ਪਰ ਉਹ ਤੋਂ ਬਾਅਦ ਵੀ ਇੱਕ ਹਫ਼ਤਾ ਮੇਰਾ ਔਡਰ ਨਹੀਂ ਆਇਆ ਹਫ਼ਤੇ ਬਾਅਦ ਜਦੋਂ ਮੇਰਾ ਔਡਰ ਆਇਆ ਜਦੋਂ ਮੈਂ ਔਡਰ ਦੇਖਿਆ ਤਾਂ ਉਹ ਚਾਰਜਰ ਸੈਮਸੌਂਗ ਕੰਪਨੀ ਦਾ ਨਹੀਂ ਸੀਗਾ ਅਤੇ ਨਾ ਹੀ ਉਹਦੀ ਡਾਟਾ ਕੇਬਲ ਵਧੀਆ ਸੀਗੀ ਅਤੇ ਨਾ ਹੀ ਉਹ ਚੱਜ ਨਾਲ ਫੋਨ ਚਾਰਜ ਕਰਦਾ ਸੀਗਾ ਜਿਹਦੇ ਕਰਕੇ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਅਤੇ ਬਾਅਦ ਚੌਂ ਜਦੋਂ ਮੈਂ ਉਹਨਾਂ ਨੂੰ ਪ੍ਰੋਡਕਟ ਰਿਟਰਨ ਵਾਸਤੇ ਹੋਰ ਮੇਲ ਪਾਈ ਤਾਂ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਅਤੇ ਜਿਹਦੇ ਕਰਕੇ ਮੈਨੂੰ ਬਹੁਤ ਜ਼ਿਆਦਾ ਮੈਨੂੰ ਪੈਸਿਆਂ ਦਾ ਨੁਕਸਾਨ ਹੋਇਆ ਅਤੇ ਨਾ ਹੀ ਉਹਨਾਂ ਨੇ ਕੋਈ ਰੀਫੰਡ ਕੀਤਾ ਅਤੇ ਨਾ ਹੀ ਉਹਨਾਂ ਨੇ ਰਿਟਰਨ ਬਾਏ ਦੁਆਰਾ ਕੋਈ ਈਮੇਲ ਕੀਤੀ